ਇਹ ਕੰਮ ਬਹੁਤ ਹੀ ਵਧੀਆ ਹੈ ਜਿਹੜੇ ਲੋਕ ਹੁਣ ਤੋਂ ਹੀ ਆਪਣੀ ਸਥਿਰਤਾ ਬਣਾਉਣਾ ਸ਼ੁਰੂ ਕਰ ਰਹੇ ਹਨ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਔਖਾ ਹੋਣ ਵਾਲਾ ਹੈ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਹਰ ਇੱਕ ਆਮ ਇਨਸਾਨ ਦੇ ਖਰਚੇ ਦਿਨ ਬ ਦਿਨ ਵਧਦੇ ਜਾ ਰਹੇ ਹਨ ਕੋਈ ਵੀ ਇਨਸਾਨ ਐਸਾ ਨਹੀਂ ਹੋਵੇਗਾ ਜਿਹਦੀ ਕੀ ਮਹੀਨੇ ਦੀ ਤਨਖਾਹ ਰਾਸ਼ਨ ਪਾਣੀ ਵਿੱਚ ਬਹੁਤ ਜ਼ਿਆਦਾ ਨਾ ਜਾਂਦੀ ਹੋਵੇ ਮੰਨ ਲਓ ਜੇਕਰ ਕਿਸੇ ਦੀ ਤਨਖਾਹ ਇੱਕ ਆਮ ਬੰਦੇ ਦੀ ਦਸ ਹਜ਼ਾਰ ਵੀ ਹੈ ਤਾਂ ਉਸ ਦੀ ਤਾਂ ਅੱਠ ਹਜ਼ਾਰ ਰੁਪਿਆ ਤਨਖਾਹ ਘਰ ਦੇ ਆਮ ਖਰਚਿਆਂ 'ਚ ਚਲੀ ਜਾਂਦੀ ਹੈ ਬਿਜਲੀ ਦੇ ਖਰਚੇ ਵਿੱਚ ਪਾਣੀ ਦੇ ਖਰਚੇ ਵਿੱਚ ਚਲੀ ਜਾਂਦੀ ਹੈ ਘਰ ਦਾ ਰਾਸ਼ਨ ਲਿਆਉਣਾ ਹੁੰਦਾ ਹੈ ਬੱਚੇ ਦੀ ਫੀਸ ਭਰਨੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਖਰਚੇ ਹੁੰਦੇ ਹਨ ਅਤੇ ਇੱਕ ਆਮ ਜਿਹੜਾ ਇਨਸਾਨ ਹੈ ਜੋ ਕਿ ਅੱਜ ਤੋਂ ਹੀ ਆਪਣੀ ਆਮਦਨ ਨੂੰ ਜੋੜਨਾ ਸ਼ੁਰੂ ਕਰ ਰਿਹਾ ਹੈ ਭਾਵੇਂ ਥੋੜ੍ਹਾ ਥੋੜ੍ਹਾ ਹੀ ਜੋੜਨਾ ਸ਼ੁਰੂ ਕਰ ਰਿਹਾ ਹੈ ਪਰ ਜੇ ਜੋੜ ਰਿਹਾ ਹੈ ਤਾਂ ਉਸ ਨੂੰ ਬਹੁਤ ਹੀ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਮੁਨਾਫਾ ਵੀ ਹੋਏਗਾ ਕਿਉਂਕਿ ਤੁਸੀਂ ਇਹ ਗੱਲ ਸਮਝ ਨਹੀਂ ਸਕਦੇ ਹੋ ਐਮਰਜੈਂਸੀ ਫੰਡ ਕਿਸੇ ਵੀ ਰੱਬ ਨਾ ਕਰੇ ਜੇ ਕਿਸੇ ਕਾਨੂੰ ਅੱਜ ਕੱਲ੍ਹ ਮੁਸੀਬਤ ਪੈ ਹੀ ਜਾਂਦੀ ਹੈ ਉਹ ਮੁਸੀਬਤ ਆਉਣ ਵਾਲੇ ਸਮੇਂ ਵਾਸਤੇ ਉਹ ਇਕੱਠੀ ਕਰ ਰਿਹਾ ਹੈ ਤੁਸੀਂ ਇਹ ਸੋਚ ਸਕਦੇ ਹੋ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਇੱਕ ਆਮ ਇਨਸਾਨ ਨੂੰ ਮੁਸੀਬਤ ਪੈ ਰਹੀ ਹੈ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਹੀ ਪਹਿਲਾਂ ਹੀ ਉਹਨੇ ਉਸ ਆਪਣੀ ਮਾਇਆ ਜੋੜ ਕੇ ਰੱਖੀ ਹੋਏਗੀ ਜਿਸ ਨੂੰ ਉਹ ਲਾ ਸਕੇਗਾ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ ਘਰ ਘਰ ਬਿਮਾਰੀਆਂ ਚਾਲੂ ਹੋ ਹੀ ਗਈਆਂ ਹਨ ਠੀਕ ਹੈ ਜੇਕਰ ਕਿਸੇ ਨੂੰ ਬਿਮਾਰੀ ਵੱਡੀ ਹੋਵੇ ਤਾਂ ਪੈਸਾ ਵੀ ਵੱਡਾ ਹੀ ਲੱਗਦਾ ਹੈ ਅਤੇ ਇਸ ਤੋਂ ਤੁਸੀਂ ਸੋਚ ਸਕਦੇ ਹੋ ਕਿ ਜੇਕਰ ਆਪਾਂ ਪਹਿਲਾਂ ਤੋਂ ਹੀ ਪੈਸਾ ਜੋੜਨਾ ਸ਼ੁਰੂ ਕਰ ਦਿੱਤਾ ਹੈ ਤਾਂ ਉਸ ਦਾ ਸਾਨੂੰ ਆਉਣ ਵਾਲੇ ਸਮੇਂ ਵਿੱਚ ਕਿੰਨਾ ਜ਼ਿਆਦਾ ਵਾਧਾ ਪੈ ਸਕਦਾ ਹੈ ਇਸ ਨਾਲ ਤੁਸੀਂ ਆਪਣੇ ਬਜਟ ਘੱਟ ਕਰ ਸਕਦੇ ਹੋ ਜੇ ਮੰਨ ਲਓ ਤੁਹਾਡੇ ਦਸ ਹਜ਼ਾਰ ਰੁਪਈਆ ਤਨਖਾਹ ਹੈ ਤਾਂ ਤੁਸੀਂ ਉਸ ਹਿਸਾਬ ਨਾਲ ਹੀ ਉਸ ਦਾ ਖਰਚਾ ਕਰ ਸਕਦੇ ਹੋ ਤੁਸੀਂ ਆਪਣਾ ਇੱਕ ਸ ਸਮਾਨ ਬਣਾ ਸਕਦੇ ਹੋ ਕਿ ਜੇਕਰ ਆਪਾਂ ਦਸ ਹਜ਼ਾਰ ਵਿੱਚੋਂ ਨੌਂ ਹਜ਼ਾਰ ਜਾਂ ਅੱਠ ਹਜ਼ਾਰ ਹੀ ਖਰਚਣਾ ਹੈ ਤਾਂ ਬਾਕੀ ਦਾ ਪੈਸਾ ਜੋੜਨਾ ਹੈ ਇਸ ਨਾਲ ਵੀ ਤੁਹਾਡੀ ਬਹੁਤ ਜ਼ਿਆਦਾ ਮਦਦ ਹੋਵੇਗੀ ਆਉਣ ਵਾਲੇ ਸਮੇਂ ਵਿੱਚ ਇਹ ਬਹੁਤ ਹੀ ਲਾਭਦਾਇਕ ਹੋਏਗਾ ਜਿਹੜੇ ਲੋਕ ਹੁਣ ਤੋਂ ਹੀ ਆਪਣੇ ਸਥਿਰਤਾ ਬਣਾਉਣੇ ਚਾਲੂ ਕਰ ਚੁੱਕੇ ਹਨ ਉਹਨਾਂ ਨੂੰ ਤਾਂ ਇਹ ਬਹੁਤ ਹੀ ਵਧੀਆ ਅਤੇ ਮਦਦਗਾਰ ਸਾਬਿਤ ਹੋਏਗਾ